ਕਿਸੇ ਵੀ ਜ਼ਿਲ੍ਹੇ ਅਤੇ ਕਿਸੇ ਵੀ ਰਾਜ ਦੇ ਵਿਕਾਸ ਦੇ ਵਿੱਚ ਪ੍ਰਸ਼ਾਸਨ ਦਾ ਸਭ ਤੋਂ ਵ ਮਹੱਤਵਪੂਰਨ ਹੱਥ ਹੁੰਦਾ ਹੈ ਅਗਰ ਕਿਸੇ ਰਾਜ ਦੇ ਵ ਵਿਕਾਸ ਨੂੰ ਵੇਖਿਆ ਜਾਵੇ ਤਾਂ ਸਿਰਫ਼ ਇੱਕ ਸਰਕਾਰ ਦੇ ਹੱਥ 'ਚ ਹੀ ਹੁੰਦਾ ਹੈ ਕਿ ਉਹਦਾ ਵਿਕਾਸ ਕਰ ਸਕਦਾ ਹੈ ਅਤੇ ਤਰਨ ਤਾਰਨ ਜ਼ਿਲ੍ਹੇ ਦੇ ਵਿਕਾਸ ਨੂੰ ਜੋ ਸਰ ਕ ਕਰਨ ਲਈ ਜੋ ਸਰਕਾਰ ਨੇ ਪਹਿਲਕਦਮੀਆਂ ਕੀਤੀਆਂ ਹਨ ਉਹਦਾ ਕਾਫ਼ੀ ਚੰਗਾ ਪਰਿਣਾਮ ਰਿਹਾ ਹੈ ਜਿਵੇਂ ਕਿ ਬੇਟੀ ਬਚਾਓ ਅਤੇ ਬੇਟੀ ਪੜ੍ਹਾਓ ਅਭਿਆਨ ਚਲਾਇਆ ਗਿਆ ਅਤੇ ਇਹਦੇ ਅਨੁਸਾਰ ਮੀਨਸ ਅਗਰ ਤੁਸੀਂ ਬੇਟੀ ਨੂੰ ਬਚਾਉਣਾ ਹੈ ਜਿਵੇਂ ਕਿ ਭਰੂਣ ਹੱਤਿਆ ਵਗੈਰਾ ਲੋਕ ਕਰ ਦਿੰਦੇ ਹਨ ਉਹਨਾਂ ਦੇ ਜਨਮ ਦੇਣ ਤੋਂ ਪਹਿਲਾਂ ਹੀ ਭਰੂਣ ਹੱਤਿਆ ਹੋ ਜਾਂਦੀ ਹੈ ਅਤੇ ਐਵੇਂ ਦਾ ਕੰਮਾਂ 'ਤੇ ਰੋਕ ਲਾ ਕੇ ਉਹਨਾਂ 'ਤੇ ਅਤੇ ਸਰਕਾਰ ਨੇ ਕੁੜੀਆਂ ਦੀ ਰਕਸ਼ਾ ਕੀਤੀ ਹੈ ਅਤੇ ਬੇਟੀ ਪੜ੍ਹਾਓ ਔਰ ਉਹਨਾਂ ਨੇ ਇਹ ਕਿਹਾ ਹੈ ਕਿ ਅਗਰ ਮੰਨ ਲਓ ਇੱਕ ਔਰਤ ਪੜ੍ਹਦੀ ਹੈ ਤਾਂ ਪੂਰੀ ਪੂਰਾ ਵੰਸ਼ ਹੀ ਪੜ੍ਹ ਜਾਂਦਾ ਹੈ ਅਤੇ ਇਸ ਗੱਲ ਨੂੰ ਮਹੱਤਵਪੂਰਨ ਰੱਖਦਿਆਂ ਉਹਨਾਂ ਨੇ ਕਿਹਾ ਕਿ ਬੇਟੀ ਨੂੰ ਪੜ੍ਹਾਉਣਾ ਬਹੁਤ ਹੀ ਜ਼ਰੂਰੀ ਹੈ ਅਤੇ ਸਰਕਾਰ ਨੇ ਅਲੱਗ ਅਲੱਗ ਤਰ੍ਹਾਂ ਦੀਆਂ ਨੀਤੀਆਂ ਚਲਾਈਆਂ ਹਨ ਜਿਵੇਂ ਕਿ ਮਾਈ ਭਾਗੋ ਵਿਦਿਆ ਸਕੀਮ ਅਤੇ ਮਾਈ ਭਾਗੋ ਵਿੱਦਿਆ ਸਕੀਮ ਦੇ ਵਿੱਚ ਬੱਚੀਆਂ ਨੂੰ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਹਨ ਕਿ ਜਿਵੇਂ ਕਿ ਕੋਈ ਫ੍ਰੀ ਕਿਤਾਬਾਂ ਦਿੱਤੀਆਂ ਗਈਆਂ ਹਨ ਅਤੇ ਉਹਨਾਂ ਨੂੰ ਕਈ ਤਰ੍ਹਾਂ ਦੇ ਆਉਣ ਜਾਣ ਵਾਸਤੇ ਮੀਨਸ ਸਾਈਕਲ ਵਗੈਰਾ ਦਿੱਤੇ ਗਏ ਹਨ ਅਤੇ ਕਦਮ ਕਦਮ 'ਤੇ ਉਹਨੂੰ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ ਅਤੇ ਤਰਨ ਤਾਰਨ ਜ਼ਿਲ੍ਹੇ ਦੇ ਵਿਕਾਸ ਦੇ ਲਈ ਸਰਕਾਰ ਨੇ ਵੀ ਪਹਿਲ ਕ ਕਦਮ ਚੁੱਕਿਆ ਹੈ ਕਿ ਲੋਕਾਂ ਨੂੰ ਡਰੱਗਸ ਦਾ ਜਿਵੇਂ ਕਈ ਤਰ੍ਹਾਂ ਦੇ ਲੋਕ ਨਸ਼ੇ ਕਰਦੇ ਹਨ ਅਤੇ ਉਹਨਾਂ ਵਾਸਤੇ ਲੋਕਾਂ ਨੂੰ ਕਾਫ਼ੀ ਜ਼ਿਆਦਾ ਜਾਗਰੂਕ ਕੀਤਾ ਗਿਆ ਕਿ ਨਸ਼ੇ ਸਾਡੀ ਸਿਹਤ ਵਾਸਤੇ ਬਹੁਤ ਮਾੜੇ ਹਨ ਅਤੇ ਸਾਨੂੰ ਆਰਥਿਕ ਤੌਰ 'ਤੇ ਬਿਲਕੁਲ ਹੀ ਨਿ ਨਿਮਨ ਨੀਚਾ ਕਰ ਦਿੰਦੇ ਹਨ ਇਸ ਕਰਕੇ ਸਰਕਾਰ ਨੇ ਕਾਫ਼ੀ ਜ਼ਿਆਦਾ ਚੰਗੇ ਚੰਗੇ ਕਦਮ ਉਠਾਏ ਹਨ ਕਿ ਤਰਨ ਤਾਰਨ ਜ਼ਿਲ੍ਹੇ ਦਾ ਵਿਕਾਸ ਹੋ ਸਕੇ ਲੇਕਿਨ ਜੋ ਦਫ਼ਤਰਾਂ ਦੇ ਸਰਕਾਰੀ ਦਫ਼ਤਰਾਂ ਜੋ ਸੇਵਾ ਪੇਸ਼ ਕਰਦੀਆਂ ਹਨ ਕਈ ਵਾਰ ਐਵੇਂ ਹੁੰਦਾ ਹੈ ਕਿ ਜਿਹਨਾਂ ਦੀ ਜ਼ਿਆਦਾ ਜਾਣ ਪਹਿਚਾਣ ਹੁੰਦੀ ਹੈ ਜ਼ਿਆਦਾ ਕੁਛ ਉਹਨਾਂ ਦਾ ਰੁਤਬਾ ਹੁੰਦਾ ਹੈ ਤਾਂ ਉਹਨਾਂ ਦੀ ਸੁਣਵਾਈ ਜਲਦੀ ਹੁੰਦੀ ਹੈ ਅਤੇ ਜਿਹੜੇ ਨਿਮਨ ਰੁਤਬੇ ਦੇ ਲੋਕ ਹੁੰਦੇ ਹਨ ਥੋੜ੍ਹਾ ਜਿ ਆਰਥਿਕ ਤੌਰ 'ਤੇ ਪਿਛੜੇ ਹੋਏ ਹੁੰਦੇ ਹਨ ਜਾਂ ਜਿਹਨਾਂ ਦਾ ਕੋਈ ਸਰਕਾਰੀ ਲੈਣ ਦੇਣ ਐਸਾ ਨਹੀਂ ਹੁੰਦਾ ਕੋਈ ਰੈਪੁਟੇਸ਼ਨ ਕੋਈ ਜ਼ਿਆਦਾ ਸਟੈਂਡਰਡ ਹਾਈ ਨਹੀਂ ਹੁੰਦਾ ਤਾਂ ਉਹਨਾਂ ਦਾ ਕੰਮ ਵੀ ਬਹੁਤ ਲੇਟ ਕੀਤਾ ਜਾਂਦਾ ਅਤੇ ਉਹਨਾਂ ਦੀ ਸੁਣਵਾਈ ਵੀ ਬਹੁਤ ਲੇਟ ਹੁੰਦੀ ਹੈ ਅਤੇ ਇਸ ਕਰਕੇ ਸਰਕਾਰ ਨੂੰ ਜਿਹੜਾ ਇਹ ਕਰਪਸ਼ਨ ਇਹ ਭ੍ਰਿਸ਼ਟਾਚਾਰ ਜਾਂ ਸਿਸਟਮ ਹੈ ਇਹ ਵੀ ਖ਼ਤਮ ਕਰਨਾ ਚਾਹੀਦਾ ਹੈ ਕਿਉਂਕਿ ਜੋ ਸਰਕਾਰੀ ਸੇਵਾਵਾਂ ਹਨ ਉਹ ਸਾਰਿਆਂ ਵਾਸਤੇ ਬਰਾਬਰ ਹੋਣੀਆਂ ਚਾਹੀਦੀਆਂ ਹਨ

ਅਤੇ ਇਸ ਕਰਕੇ ਫਿਰ ਹੀ ਇਹ ਸਾਰੀਆਂ ਨੀਤੀਆਂ ਕਾਮਯਾਬ ਹੋਣਗੀਆਂ ਅਗਰ ਅਸੀਂ ਸਾਰੇ ਲੋਕਾਂ ਨੂੰ ਬਰਾਬਰੀ ਦਾ ਦਰਜਾ ਦੇਵਾਂਗੇ ਸਿਰਫ਼ ਇੱਕ ਦਸਤਾਵੇਜ਼ ਦੇ ਅਕੋਰਡਿੰਗ ਜਾਂ ਫਿਰ ਸਿਰਫ਼ ਕਾਗਜ਼ਾਂ ਦੇ ਵਿੱਚ ਹੀ ਅਸੀਂ ਇਹਨਾਂ ਨੀਤੀਆਂ ਨੂੰ ਨਹੀਂ ਰੱਖਣਾ ਚਾਹੁੰਦੇ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਪੂਰੀ ਤਰ੍ਹਾਂ ਤੇ ਲਾਗੂ ਕਰੇ ਅਤੇ ਅਗਰ ਲਾਗੂ ਕੀਤੀਆਂ ਹਨ ਇਹ ਨੀਤੀਆਂ ਤਾਂ ਪੂਰੀ ਤਰ੍ਹਾਂ ਤੇ ਇਹਨਾਂ ਦਾ ਨਿਰੀਖਣ ਵੀ ਕਰੇ ਅਤੇ ਕਿਆ ਇਹ ਨੀਤੀਆਂ ਲਾਗੂ ਹੋ ਰਹੀਆਂ ਹਨ ਅਤੇ ਕਿੰਨੀਆਂ ਕਾਮਯਾਬ ਹੋ ਗਈਆਂ ਹਨ